ਮੇਰਾ ਮੰਨਣਾ ਹੈ ਕਿ ਪੰਜਾਬ ਵਿੱਚ ਕਈ ਸੈਰ ਸਪਾਟੇ ਵਾਲੀ ਜਗ੍ਹਾਵਾਂ ਹਨ ਪੰਜਾਬ ਵਿੱਚ ਸੰਸਕ੍ਰਿਤਿਕ ਵਿਰਾਸਤ ਅਤੇ ਇਤਿਹਾਸਿਕ ਸਥਾਨਾਂ ਤੋਂ ਇਲਾਵਾ ਸ਼ੋਪਿੰਗ ਕਪਲੈਕਸ ਅਤੇ ਮੌਲ ਵੀ ਹਨ ਜੋ ਇਸ ਨੂੰ ਸੈਰ ਸਪਾਟੇ ਲਈ ਇੱਕ ਚਮਕਦਾਰ ਮੰਜ਼ਿਲ ਬਣਾਉਂਦੇ ਹਨ ਇਤਿਹਾਸਿਕ ਸਥਾਨ ਜਿਵੇਂ ਕਿ ਸਵਰਨ ਮੰਦਰ ਜਿਸ ਦੀ ਸਾਜਣਾ ਸ਼੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ ਇਹ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ ਅਤੇ ਜਲ੍ਹਿਆਂਵਾਲਾ ਬਾਗ ਜਿਸ ਵਿੱਚ ਕਈ ਲੋਕਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ ਇਹ ਵੀ ਅੰਮ੍ਰਿਤਸਰ ਸ਼ਹਿਰ ਵਿੱਚ ਸਥਿਤ ਹੈ ਘੁੰਮਣ ਫਿਰਨ ਲਈ ਅਤੇ ਸ਼ੋਪਿੰਗ ਕਰਨ ਲਈ ਕੰਪਲੈਕਸ ਜਿਵੇਂ ਕਿ ਪੀ ਵੀ ਆਰ ਪਲਾਜ਼ਾ ਜਲੰਧਰ ਇਹ ਮੌਲ ਕਈ ਦੁਕਾਨਾਂ ਸਿਨੇਮਾ ਹੋਲਾਂ ਅਤੇ ਭੋਜਨ ਕੇਂਦਰਾਂ ਨਾਲ ਮਿਲ ਕੇ ਬਣਿਆ ਹੈ ਅਤੇ ਮੌਲ ਆਫ ਅੰਮ੍ਰਿਤਸਰ ਇਹ ਸ਼ਹਿਰ ਦਾ ਸਭ ਤੋਂ ਵੱਡਾ ਮੌਲ ਹੈ ਇਸ ਵਿੱਚ ਕਈ ਬ੍ਰੈਂਡ ਦੇ ਕੱਪੜੇ ਕਈ ਬ੍ਰੈਂਡ ਦੀਆਂ ਚੀਜ਼ਾਂ ਅਤੇ ਖਾਣ ਪੀਣ ਦੀਆਂ ਚੀਜ਼ਾਂ ਮਿਲਦੀਆਂ ਹਨ